ਜਿਵੇਂ ਕਿ ਹੁਣ ਗਰਮੀ ਦਾ ਮੌਸਮ ਅਜੇ ਗਰਮੀ ਦੇ ਮੌਸਮ ਵਿੱਚ ਪਾਣੀ ਤੋਂ ਬਿਨਾਂ ਜ਼ਿੰਦਗੀ ਮੈਨੂੰ ਨਹੀਂ ਲੱਗਦਾ ਕੁਛ ਹੈਗੀ ਆ ਡਿਊਟੀ ਦੇ ਦੌਰਾਨ ਕੰਮ ਦੇ ਦੌਰਾਨ ਕੋਈ ਵੀ ਫਿਜੀਕਲੀ ਫਿਜੀਕਲ ਜਾਂ ਮੈਂਟਲ ਆਪਾਂ ਐਕਟੀਵਿਟੀ ਕਰ ਰਹੇ ਹਾਂ ਤਾਂ ਉਸੇ ਦੌਰਾਨ ਪਾਣੀ ਦੀ ਬਹੁਤ ਇੰਪੋਰਟੈਂਟਸ ਆ ਪਾਣੀ ਤੋਂ ਬਿਨਾਂ ਮੈਨੂੰ ਨਹੀਂਨੀ ਲੱਗਦਾ ਕੇ ਕੋਈ ਜ਼ਿੰਦਗੀ ਹੈਗੀ ਸਿਆਣੇ ਲੋਕ ਕਹਿ ਕੇ ਗਏ ਆ ਕਿ ਵਿਦਆਊਟ ਖਾਣਾ ਬੰਦਾ ਇੱਕ ਹਫ਼ਤੇ ਤੱਕ ਜਿਊਂਦਾ ਰਹਿ ਸਕਦਾ ਸੱਤ ਦਿਨ ਤੱਕ ਜਿਊਂਦਾ ਰਹਿ ਸਕਦਾ ਲੇਕਿਨ ਪ੍ਰੋਪਰ ਪਾਣੀ ਤੋਂ ਬਿਨਾਂ ਸੱਤ ਘੰਟੇ ਤੱਕ ਵੀ ਨਹੀਂ ਜਿਉ ਸਕਦਾ